ਮੈਂ ਪਿਛਲੇ ਮਹੀਨੇ ਆਪਣੇ ਪੁੱਤਰ ਨੂੰ ਮਿਲਣ ਲਈ ਕਨੇਡਾ ਗਈ ਸੀ ਕਿਉਂਕਿ ਉਸ ਦਾ ਜਨਮਦਿਨ ਸੀ ਇਸ ਬਹਾਨੇ ਮੈਂ ਆਪਣੇ ਪੁੱਤਰ ਨੂੰ ਚਾਰ ਸਾਲਾਂ ਬਾਅਦ ਮਿਲੀ ਸੀ ਅਤੇ ਮੈਂ ਆਪਣੇ ਬੱਚੇ ਨੂੰ ਮਿਲ ਕੇ ਬਹੁਤ ਖੁਸ਼ ਹੋਈ ਅਤੇ ਮੇਰਾ ਪੁੱਤਰ ਵੀ ਮੈਨੂੰ ਮਿਲ ਕੇ ਬਹੁਤ ਖੁਸ਼ ਹੋਇਆ